ਸਰਕਾਰ ਨੇ ਜਿਹੜੇ ਗੌਰਮੈਂਟ ਹੋਸਪਿਟਲ ਖੋਲ੍ਹੇ ਹਨ ਉਹਨਾਂ ਵਿੱਚ ਹਰ ਤਰ੍ਹਾਂ ਦੀ ਸਹੂਲਤ ਅਵੇਲੇਬਲ ਹੁੰਦੀ ਹੈ ਬਟ ਜਿਹੜੇ ਆਮ ਆਦਮੀ ਨੂੰ ਉੱਥੇ ਦ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੋਂ ਦੇ ਜਿਹੜੇ ਜਿਹੜੀਆਂ ਚੀਜ਼ਾਂ ਹੁੰਦੀਆਂ ਹਨ ਮਸ਼ੀਨਾਂ ਵਗੈਰਾ ਪੁਰਾਣੀਆਂ ਬੜੇ ਔਬਸੋਲੇਟ ਹੁੰਦੀਆਂ ਹਨ ਐਕਸਰੇ ਵਗੈਰਾ ਦੀ ਫੈਸਿਲਿਟੀ ਵੀ ਹੁੰਦੀ ਆ ਫਰੀ ਕਰਨ ਦੀ ਬਟ ਉੱਥੇ ਕਈ ਤਰ੍ਹਾਂ ਦੇ ਜਿਹੜੇ ਹੈ ਉਹ ਚੀਜ਼ਾਂ ਨਹੀਂ ਮਿਲਦੀਆਂ ਜੋ ਪ੍ਰਾਈਵੇਟ ਹਸਪਤਾਲਾਂ 'ਚ ਮਿਲਦੀਆਂ ਹਨ ਐਮਰਜੈਂਸੀ ਸੇਵਾਵਾਂ ਲਈ ਕਈ ਵਾਰੀ ਡੋਕਟਰ ਵੀ ਅਵੇਲੇਬਲ ਨਹੀਂ ਹੁੰਦੇ ਪਰ ਇਹ ਡਾਕਟਰਾਂ ਨੂੰ ਇਹ ਇੰਟਰਸਟ ਹੁੰਦਾ ਹੈ ਕਿ ਜਿਹੜਾ ਵੀ ਮਰੀਜ਼ ਆਇਆ ਹੈ ਜੇ ਉਹ ਉਸ ਨੂੰ ਆਪਣੇ ਨਿਜੀ ਹਸਪਤਾਲ 'ਚ ਉਹਦਾ ਇਲਾਜ ਕਰਵਾਈਏ ਅਤੇ ਉਹਨਾਂ ਨੂੰ ਹੋਰ ਫਾਇਦਾ ਹੋਏਗਾ ਗੌਰਮੈਂਟ ਡਾਕਟਰ ਆਮ ਤੌਰ 'ਤੇ ਪ੍ਰਾਈਵੇਟ ਪ੍ਰੈਕਟਿਸ ਵੀ ਕਰਦੇ ਹਨ ਜਿਹਦੇ 'ਤੇ ਸਖਤ ਪਾਬੰਦੀ ਹੋਣੀ ਚਾਹੀਦੀ ਹੈ ਔਰ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਬੇਸ਼ੱਕ ਖਰਚਾ ਵੱਧ ਲੱਗਦਾ ਹੈ ਜ਼ਰੂਰਤ ਤੋਂ ਜ਼ਿਆਦਾ ਪੈਸੇ ਵੀ ਲੱਗਦੇ ਨੇ ਪਰ ਇਲਾਜ ਜਿਹੜਾ ਉਹ ਆਪਣੀ ਪਸੰਦ ਦਾ ਬੰਦਾ ਕਰਵਾ ਸਕਦਾ ਹੈ ਅਤੇ ਟਾਈਮ ਸਿਰ ਫਰੀ ਵੀ ਹੋ ਸਕਦਾ ਹੈ ਔਰ ਜਿਸ ਲਈ ਸਰਕਾਰੀ ਹਸਪਤਾਲ 'ਚ ਜਾਂਦੇ ਹਾਂ ਉੱਥੇ ਕਈ ਤਰ੍ਹਾਂ ਬਹੁਤ ਜ਼ਿਆਦਾ ਰਸ਼ ਹੁੰਦਾ ਜਿਹਦੇ ਕਰਕੇ ਬੰਦਾ ਇਹ ਚਾਹੁੰਦਾ ਕਿ ਜਿਹੜਾ ਟ੍ਰੀਟਮੈਂਟ ਹੈ ਮੈਨੂੰ ਇਮੀਡੀਏਟਲੀ ਮਿਲੇ ਜਿਹੜਾ ਕਿ ਨਹੀਂ ਮਿਲ ਪਾਉਂਦਾ ਇਸ ਕਰਕੇ ਲੋਕ ਪ੍ਰਾਈਵੇਟ ਹਸਪਤਾਲਾਂ ਨੂੰ ਪ੍ਰੈਫਰ ਕਰਦੇ ਹਨ ਖਰਚੇ ਦੀ ਉਸ ਵੇਲੇ ਪ੍ਰਵਾਹ ਨਹੀਂ ਕੀਤੀ ਜਾਂਦੀ